ਪੰਜਾਬ ਵਿੱਚ ਆਵਾਜਾਈ ਦੇ ਸਾਧਨ ਬਹੁਤ ਸਾਰੇ ਨੇ ਅਤੇ ਇਹਨਾਂ ਸਾਧਨਾਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਵੀ ਹੋਈ ਹੈ ਪਹਿਲੇ ਦੇ ਸਮੇਂ ਦੇ ਵਿੱਚ ਬੈਲ ਗੱਡੀਆਂ ਹੁੰਦੀਆਂ ਸੀ ਅਤੇ ਉਸਦੇ ਬਾਅਦ ਸਾਈਕਲ ਆਏ ਅਤੇ ਫਿਰ ਮੋਟਰਸਾਈਕਲਾਂ ਆਈਆਂ ਅਤੇ ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬੱਸਾਂ ਆ ਗਈਆਂ ਨੇ ਰੇਲ ਗੱਡੀਆਂ ਨੇ ਅਤੇ ਸਭ ਦੇ ਘਰ ਵਿੱਚ ਅੱਜ ਕੱਲ੍ਹ ਗੱਡੀਆਂ ਹੈਗੀਆਂ ਨੇ ਅਤੇ ਲੋਕ ਆਪਣੀ ਗੱਡੀਆਂ ਦਾ ਹੀ ਜ਼ਿਆਦਾਤਰ ਇਸਤੇਮਾਲ ਕਰਦੇ ਨੇ